ਉੱਚਾ ਨੀਵਾਂ ਬੋਲਣਾ ਗਲਤ ਬੋਲਣਾ ਅੱਖਾਂ ਵਿੱਚ ਘੱਟਾ ਪਾਉਣਾ ਧੋਖਾ ਦੇਣਾ ਅੱਖਾਂ ਵਿੱਚ ਰੜਕਣਾ ਬੁਰਾ ਲੱਗਣਾ ਇੱਕ ਮੁੱਠ ਹੋਣਾ ਏਕਤਾ ਹੋਣੀ ਈਨ ਨਾ ਮੰਨਣਾ ਹਾਰ ਨਾ ਮੰਨਣਾ ਹੱਥ ਤੰਗ ਹੋਣਾ ਪੈਸੇ ਦੀ ਕਮੀ ਹੋਣਾ ਹਾਰ ਹੋ ਜਾਣਾ ਭੱਜ ਜਾਣਾ